ਮੈਂ ਪੰਜਾਬ ਦਾ ਰਹਿਣ ਵਾਲਾ ਨਿਵਾਸੀ ਹਾਂ ਮੈਂ ਜਦੋਂ ਵੀ ਸ਼੍ਰੀ ਦਰਬਾਰ ਸਾਹਿਬ ਜਾਂਦਾ ਹਾਂ ਤਾਂ ਉੱਥੇ ਮੈਨੂੰ ਕਈਆਂ ਤਰਾਂ ਦੇ ਸੈਲਾਨੀਆਂ ਨਾਲ ਮੇਰੀ ਮੁਲਾਕਾਤ ਹੁੰਦੀ ਹੈ ਉੱਥੇ ਪ੍ਰਾਂਤ ਪ੍ਰਾਂਤ ਦੇ ਸੈਲਾਨੀ ਇੱਥੇ ਮੱਥਾ ਟੇਕਣ ਆਉਂਦੇ ਹਨ ਇੱਥੋਂ ਕਈ ਬਾਹਰਲੇ ਦੇਸ਼ਾਂ ਵਿੱਚ ਜਾਂ ਹੋਰ ਸਟੇਟਾਂ ਵਿੱਚ ਕਈਆਂ ਸੈਲਾਨੀਆਂ ਨਾਲ ਮੇਰੀ ਮੁਲਾਕਾਤ ਹੁੰਦੀ ਹੈ ਮੈਂ ਹਰ ਵੇਲੇ ਇਹਨਾਂ ਦੀ ਉਡੀਕ ਕਰਦਾ ਹਾਂ ਕਿ ਕੋਈ ਸੈਲਾਨੀ ਮਿਲੇ ਤਾਂ ਮੈਂ ਉਹਨੇ ਕੋਲ ਕੁਛ ਆਪਣਾ ਬਾਰੇ ਦੱਸਾਂ ਅਤੇ ਉਸ ਤੋਂ ਕੁਛ ਬਾਰੇ ਆਪਣੇ ਬਾਰੇ ਪਤਾ ਲੱਗੇ ਤਾਂ ਕਿ ਮੇਰੀ ਨੌਲੇਜ ਵੀ ਵੱਧ ਸਕੇ ਅਤੇ ਆ ਮੈਂ ਉਹਨਾਂ ਨਾਲ ਗੱਲ ਕਰਨ ਵਿੱਚ ਕਤਰਾਵਾਂ ਨਾ ਇੱਕ ਵਾਰੀ ਮੈਂ ਜਦੋਂ ਦਰਬਾਰ ਸਾਹਿਬ ਗਿਆ ਸੀ ਤੇ ਮੈਂ ਕਿਸੇ ਕੈਨੇਡੀਅਨ ਨਾਲ ਮੁਲਾਕਾਤ ਹੋਈ ਸੀ ਉਹ ਬੰਦਾ ਬਹੁਤ ਹੀ ਮਿਲਣਸਾਰ ਵਿਅਕਤੀ ਸੀ ਉਹ ਥੋੜ੍ਹਾ ਉਮਰ 'ਚ ਥੋੜ੍ਹਾ ਜ਼ਰੂਰ ਵੱਡਾ ਸੀ ਬਟ ਫਿਰ ਵੀ